ਭਾਰਤ ਇੱਕ ਬਹੁਤ ਹੀ ਵੱਡਾ ਦੇਸ਼ ਹੈ ਜਿਸ ਵਿੱਚ ਵੱਖ ਵੱਖ ਤਰਾਂ ਦੇ ਮੌਸਮ ਹੁੰਦੇ ਹਨ ਜਿਵੇਂ ਕਿ ਰਾਜਸਥਾਨ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਰਾਜਸਥਾਨ ਵਿੱਚ ਪਹਾੜ ਸਿੱਧੇ ਹੁੰਦੇ ਹਨ ਜਿਸ ਕਰਕੇ ਹਵਾ ਸਿੱਧੀ ਲੰਘ ਜਾਂਦੀ ਹੈ ਅਤੇ ਉੱਥੇ ਵਰਖਾ ਨਹੀਂ ਹੁੰਦੀ ਜਿਸ ਕਰਕੇ ਉੱਥੇ ਗਰਮੀ ਦਾ ਮੌਸਮ ਹੁੰਦਾ ਹੈ ਜੰਮੂ ਕਸ਼ਮੀਰ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਅਤੇ ਉੱਥੇ ਬਹੁਤ ਹੀ ਜ਼ਿਆਦਾ ਬਰਫ ਪੈਂਦੀ ਹੈ ਜਿਸ ਕਰਕੇ ਉਹ ਇੱਕ ਠੰਡਾ ਸਥਾਨ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਬਹੁਤ ਹੀ ਜ਼ਿਆਦਾ ਠੰਡ ਦਾ ਮੌਸਮ ਹੁੰਦਾ ਹੈ ਉੱਥੇ ਵੀ ਬਰਫ਼ ਹੁੰਦੀ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਖੇਤਰ ਹਨ ਜਿੱਥੇ ਵੱਖ ਵੱਖ ਮੌਸਮ ਹਨ ਧੰਨਵਾਦ